ਮੇਰੇ ਪਿਤਾ ਜੀ ਸਰਦਾਰ ਸੁਖਦੇਵ ਸਿੰਘ ਅਤੇ ਮਾਤਾ ਸਰਬਜੀਤ ਕੌਰ ਜੀ ਜੋ ਕਿ ਆਪ ਵੀ ਉਸ ਟਾਈਮ ਦੇ ਵਿੱਚ ਮੇਰੇ ਮੁਤਾਬਿਕ ਬਹੁਤ ਪੜ੍ਹੇ ਲਿਖੇ ਸਨ ਉਹਨਾਂ ਨੇ ਦਸਵੀਂ ਤੋਂ ਬਾਅਦ ਇਲੈਕਟ੍ਰੀਕਲ ਇੰਜੀਨੀਅਰਿੰਗ ਵਿੱਚ ਤਿੰਨ ਸਾਲ ਦਾ ਡਿਪਲੋਮਾ ਗੌਰਮੈਂਟ ਪੋਲਟੈਕਟਿੰਗ ਗੁਰੂ ਤੇਗ ਬਹਾਦਰਗੜ੍ਹ ਰੋਡੇ ਕੋਲਜ ਤੋਂ ਜਿਹੜਾ ਫਰੀਦਕੋਟ ਤੋਂ ਪੜ੍ਹੇ ਹੋਏ ਸਨ ਅਤੇ ਮੇਰੇ ਮਾਤਾ ਜੀ ਨੇ ਉਹਨਾਂ ਟਾਈਮਾਂ ਦੇ ਵਿੱਚ ਮੈਟ੍ਰਿਕ ਤੱਕ ਪੜ੍ਹੇ ਹੋਏ ਹਨ ਜਦੋਂ ਕਿ ਕੁੜੀਆਂ ਨੂੰ ਬਹੁਤਾ ਪੜ੍ਹਾਇਆ ਨਹੀਂ ਸੀ ਜਾਂਦਾ ਅਤੇ ਇਹ ਉਹ ਜਿਹੜੀ ਮੈਂ ਪੜ੍ਹਾਈ ਕੀਤੀ ਹੈ ਇਹ ਮੇਰੇ ਮਾਤਾ ਪਿਤਾ ਦੀ ਦੇਣ ਹੈ ਮੈਂ ਆਪਣੀ ਪਹਿਲੇ ਅੱਠ ਸਾਲਾਂ ਦੀ ਜਿਹੜੀ ਸਕੂਲ ਦੀ ਵਿੱਦਿਆ ਹੈ ਉਹ ਫਿਰੋਜਪੁਰ ਕੈਂਟ ਫਿਰੋਜਪੁਰ ਛਾਉਣੀ ਤੋਂ ਹਾਸਿਲ ਕੀਤੀ ਹੈ ਅਤੇ ਜਿਸ ਸਕੂਲ ਵਿੱਚ ਮੈਂ ਪੜ੍ਹਦਾ ਸੀ ਉਸਦਾ ਨਾਮ ਸੀ ਖਾਲਸਾ ਹਾਈ ਸਕੂਲ ਓਥੇ ਮੈਂ ਪਹਿਲੀ ਤੋਂ ਲੈ ਕੇ ਅੱਠਵੀਂ ਤੱਕ ਦੀ ਵਿੱਦਿਆ ਪ੍ਰਾਪਤ ਕੀਤੀ ਜਿਸ ਵਿੱਚ ਮੈਂ ਪੰਜਵੀਂ ਅੱਠਵੀਂ ਅਤੇ ਦਸਵੀਂ ਬੋਰਡ ਦੀ ਕੀਤੀ ਅਤੇ ਨਾਲ ਨਾਲ ਅਸੀਂ ਸੁੰਦਰ ਲਿਖਾਈ ਦੀ ਪ੍ਰਤੀਯੋਗਤਾ ਵਿੱਚ ਵੀ ਜਾਂਦੇ ਰਹੇ ਜਿਹਦੇ ਜਦੋਂ ਸਾਡੇ ਟਾਈਮ ਦੇ ਵਿੱਚ ਫੱਟੀਆਂ ਦੇ ਉੱਪਰ ਕਲਮ ਦੇ ਨਾਲ ਲਿਖਾਈ ਕਰਦੇ ਸੀ ਇਸ ਕਰਕੇ ਜਿਹੜੀ ਮੇਰੀ ਪੰਜਾਬੀ ਦੀ ਲਿਖਾਈ ਹੈ ਜਾਂ ਇੰਗਲਿਸ਼ ਦੀ ਲਿਖਾਈ ਹੈ ਉਹ ਬਹੁਤ ਹੀ ਸੋਹਣੀ ਹੈ ਇਸ ਤੋਂ ਬਾਅਦ ਫਿਰ ਮੈਂ ਮੇਰੇ ਫਾਦਰ ਦੀ ਜਿਹੜੀ ਟ੍ਰਾਂਸਫਰ ਹੈ ਜਿਹੜੇ ਕਿ ਬਿਜਲੀ ਬੋਰਡ ਦੇ ਵਿੱਚ ਜ ਈ ਲੱਗੇ ਹੋਏ ਸਨ ਉਸ ਵੇਲੇ ਉਹਨਾਂ ਦੀ ਬਦਲੀ ਮੁਕਤਸਰ ਦੀ ਹੋ ਗਈ ਮੁਕਤਸਰ ਤੋਂ ਮੈਂ ਨੌਵੀਂ ਦਸਵੀਂ ਜਿਹੜੀ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਇੰਗਲਿਸ਼ ਮੀਡੀਅਮ ਦੇ ਵਿੱਚ ਕੀਤੀ ਅਤੇ ਉਸ ਤੋਂ ਬਾਅਦ ਮੈਂ ਦਸਵੀਂ ਤੋਂ ਬਾਅਦ ਫਿਰ ਮੈਂ ਜਿਹੜਾ ਨੋਨ ਮੈਡੀਕਲ ਪਲੱਸ ਵਨ ਦੇ ਵਿੱਚ ਰੱਖਿਆ ਅਤੇ ਜਿਹੜੀ ਮੇਰੀ ਮੈਂ ਦਾਖਲਾ ਲਿਆ ਸਰਕਾਰੀ ਰਜਿੰਦਰਾ ਕੋਲਜ ਬਠਿੰਡਾ ਵਿਖੇ ਦਾਖਲ ਲਿਆ ਉੱਥੇ ਮੈਂ ਦੋ ਚਾਰ ਮਹੀਨੇ ਤੱਕ ਰਿਹਾ ਪਰ ਉੱਥੇ ਮੇਰਾ ਦਿਲ ਨਾ ਲੱਗਣ ਕਰਕੇ ਫਿਰ ਮੈਂ ਵਾਪਸ ਮੁਕਤਸਰ ਵਿਖੇ ਪਲੱਸ ਵਨ ਗੌਰਮੈਂਟ ਕੋਲਜ ਤੋਂ ਕੀਤੀ ਅਤੇ ਉਸ ਦੇ ਨਾਲ ਨਾਲ ਮੈਂ ਜੇ ਈ ਟੀ ਦਾ ਇਗਜਾਮ ਵੀ ਦਿੱਤਾ ਡਿਪਲੋਮੇ ਦਾ ਉਸ ਪਹਿਲੀ ਵਾਰੀ ਜਦੋਂ ਮੇਰੀ ਕਾਉਂਸਲਿੰਗ ਹੋਈ ਤਾਂ ਮੈਨੂੰ ਸਿਵਲ ਇੰਜਨੀਅਰਿੰਗ ਦੇ ਵਿੱਚ ਮਿਲਦੀ ਸੀਗੀ ਐਡਮਿਸ਼ਨ ਚੰਡੀਗੜ੍ਹ ਸੀ ਪੀ ਸੀ ਦੇ ਵਿੱਚ ਜਿਹੜੀ ਹੋਈ ਸੀ ਉਹਦੇ ਵਿੱਚ ਮੇਰਾ ਇੰਟਰਸਟ ਨਹੀਂ ਸੀ ਉਹ ਮੈਂ ਡਰੋਪ ਕਰ ਦਿੱਤਾ ਅਤੇ ਫਿਰ ਮੈਂ ਪਲੱਸ ਟੂ ਨੋਨ ਮੈਡੀਕਲ ਕੰਟੀਨਿਊ ਕਰ ਦਿੱਤੀ ਉੱਥੇ ਜਾ ਕੇ ਗੌਰਮੈਂਟ ਕੋਲਜ ਮੁਕਤਸਰ ਵਿਖੇ ਅਤੇ ਉਥੋਂ ਉਸ ਤੋਂ ਮੈਂ ਅਗਲੇ ਸਾਲ ਜਦੋਂ ਪਸੱਸ ਟੂ ਬਾਨਵੇਂ ਦੇ ਵਿੱਚ ਪਲੱਸ ਟੂ ਦੇ ਦੌਰਾਨ ਮੈਂ ਦੁਬਾਰਾ ਫਿਰ ਜੇ ਈ ਟੀ ਦਾ ਦਿੱਤਾ ਉਸ ਵਿੱਚ ਮੇਰੀ ਸਲੈਕਸ਼ਨ ਹੋ ਗਈ ਬਹੁਤ ਵਧੀਆ ਮੇਰਾ ਰੈਂਕ ਆਇਆ ਪੂਰੇ ਪੰਜਾਬ ਦੇ ਵਿੱਚ ਅਤੇ ਫਿਰ ਮੇਰੀ ਜਿਹੜੀ ਐਡਮਿਸ਼ਨ ਹੈ ਦਾਖਲਾ ਹੈ ਉਹ ਤਿੰਨ ਸਾਲਾਂ ਦੇ ਕੋਰਸ ਇਲੈਕਟ੍ਰੀਕਲ ਇੰਜੀਨੀਅਰਿੰਗ ਲਈ ਗੌਰਮੈਂਟ ਪੋਲੀਟੈਕਨਿਕ ਗੁਰੂ ਤੇਗ ਬਹਾਦਰਗੜ੍ਹ ਜਿਹਨੂੰ ਕਿ ਰੋਡੇ ਕੋਲਜ ਵੀ ਕਹਿ ਦਿੰਦੇ ਸਨ ਉੱਥੇ ਮੇਰੀ ਸਿਲੈਕਸ਼ਨ ਹੋ ਗਈ ਤਿੰਨ ਸਾਲ ਫਿਰ ਮੈਂ ਬਾਨਵੇਂ ਤੋਂ ਪਚਾਨਵੇਂ ਉੱਥੇ ਪੜ੍ਹਾਈ ਕੀਤੀ ਉਸ ਤੋਂ ਬਾਅਦ ਫਿਰ ਮੈਂ ਇੱਕ ਸਾਲ ਬਿਜਲੀ ਬੋਰਡ ਦੇ ਵਿੱਚ ਆਪਾਂਰੈਂਟਸ ਵੀ ਕੀਤੀ ਅਤੇ ਨਾਲ ਨਾਲ ਆਪਾਂਰੈਂਟਸ ਦੇ ਵਿੱਚ ਕੀ ਹੁੰਦਾ ਹੈ ਸਟਾਈਫੰਡ ਵੀ ਮਿਲਦਾ ਹੈ ਇੱਕ ਸਾਡੇ ਟਾਈਮ ਉਹ ਇੱਕ ਹਜ਼ਾਰ ਰੁਪਇਆ ਪ੍ਰਤੀ ਮਹੀਨਾ ਮਿਲਦਾ ਸੀਗਾ ਇਹ ਸਾਲ ਦੀ ਹੁੰਦੀ ਹੈ ਉਸ ਤੋਂ ਬਾਅਦ ਫਿਰ ਮੈਂ ਜਿਹੜੀ ਨੈਸਲੇ ਇੰਡੀਆ ਲਿਮਿਟਡ ਹੈ ਮੋਗੇ ਵਿਖੇ ਉਥੇ ਮੈਂ ਐਜ਼ ਏ ਸਬ ਸਟੇਸ਼ਨ ਅਟੈਂਡੈਂਟ ਵੀ ਮੈਂ ਜੋਬ ਕੀਤੀ ਉਸ ਤੋਂ ਬਾਅਦ ਫਿਰ ਮੇਰੀ ਇੱਕ ਲਾਈਨ ਦੇ ਵਿੱਚ ਲੁਧਿਆਣੇ ਇੱਕ ਇੰਡਸਟਰੀ ਸੀਗੀ ਟਰਾਂਸਫਾਰਮਰ ਅਤੇ ਕੰਟਰੋਲ ਪੈਨਲ ਦੀ ਉਹਦੇ ਵਿੱਚ ਮੈਂ ਕਾਫੀ ਸਮਾਂ ਗੁਜ਼ਾਰਿਆ ਉਸ ਤੋਂ ਬਾਅਦ ਮੇਰੀ ਸਿਲੈਕਸ਼ਨ ਜਿਹੜੀ ਹੈ ਟਰਾਈਡੈਂਟ ਗਰੁੱਪ ਬਰਨਾਲਾ ਵਿਖੇ ਹੋਈ ਬਰਨਾਲਾ ਤੋਂ ਬਾਅਦ ਫਿਰ ਮੈਂ ਉਸ ਤੋਂ ਬਾਅਦ ਉਥੇ ਕੁਝ ਚਿਰ ਜੋਬ ਕਰਨ ਤੋਂ ਬਾਅਦ ਫਿਰ ਮੇਰੀ ਜਿਹੜੀ ਹੈ ਸਲੈਕਸ਼ਨ ਉਹ

ਨੜੇਨਵੇਂ ਦੇ ਵਿੱਚ ਮੈਂ ਇੱਥੇ ਆ ਗਿਆ ਇੱਥੇ ਮੇਰੀ ਬਤੌਰ ਲੈਬੋਰਟਰੀ ਟੈਕਨੀਸ਼ਨ ਜਿਹੜੀ ਹੈ ਉਹ ਸਲੈਕਸ਼ਨ ਹੋਈ ਅਤੇ ਇਸ ਨੌਕਰੀ ਦੇ ਦੌਰਾਨ ਦੌਰਾਨ ਮੈਂ ਫਿਰ ਆਪਣੀ ਜਿਹੜੀ ਹੈ ਯੋਗਤਾ ਵਿੱਦਿਅਕ ਯੋਗਤਾ ਵੀ ਵਧਾਈ ਮੈਂ ਬੈਚਲਰ ਆਫ ਟੈਕਨੋਲਜੀ ਜਿਹੜੀ ਹੈ ਉਹ ਥਾਪਰ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨੋਲਜੀ ਪਟਿਆਲਾ ਤੋਂ ਸੱਤ ਤੋਂ ਦਸ ਦੋ ਹਜ਼ਾਰ ਸੱਤ ਤੋਂ ਦਸ ਤੱਕ ਵਿੱਚ ਮੈਂ ਉਹ ਕੀਤੀ ਅਤੇ ਹੁਣ ਮੈਂ ਇੱਥੇ ਤਕਰੀਬਨ ਮੈਨੂੰ ਉੱਨੀ ਸੌ ਨੜੇਨਵੇਂ ਤੋਂ ਮੈਂ ਇੱਥੇ ਫਤਿਹਗੜ੍ਹ ਸਾਹਿਬ ਬਾਬਾ ਬੰਦਾ ਸਿੰਘ ਬਹਾਦਰ ਇੰਜਨੀਅਰਿੰਗ ਕੋਲਜ ਵਿੱਚ ਜੋਬ ਕਰਦਿਆਂ ਨੂੰ ਮੈਨੂੰ ਟਾਈਮ ਹੋ ਚੁੱਕਿਆ ਹੈ